ਹਾਂਜੀ ਅੱਜ ਆਪਾਂ ਗੱਲ ਕਰਾਂਗੇ ਸਾਡੇ ਖੇਤਰ ਦੇ ਵਿੱਚ ਹੈਲਥ ਕੇਅਰ ਸਿਸਟਮ ਵਿੱਚ ਦੇਖੀਆਂ ਗਈਆਂ ਬਿਹਤਰੀਆਂ ਕਿਹੜੀਆਂ ਕਿਹੜੀਆਂ ਹਨ ਜਦੋਂ ਅਸੀਂ ਹਸਪਤਾਲ ਦੇ ਵਿੱਚ ਜਾਂਦੇ ਹਾਂ ਵੀ ਉੱਥੇ ਕੀ ਕੀ ਸੁਧਾਰ ਹੋਇਆ ਇਹਦੇ ਬਾਰੇ ਜਾਣਕਾਰੀ ਕਰਾਂਗੇ ਸਾਡੇ ਖੇਤਰ ਦੇ ਵਿੱਚ ਅੱਜ ਕੱਲ੍ਹ ਕੀ ਹੈ ਜਿਹੜੇ ਹੈਲਥ ਦੇ ਨਾਲ ਰਿਲੇਟਡ ਨੇ ਆਸ਼ਾ ਵਰਕਰ ਨੇ ਹਸਪਤਾਲਾਂ ਦੇ ਵਿੱਚ ਕੀ ਹੈ ਬਹੁਤ ਵਧੀਆ ਇਕੁਪਮੈਂਟ ਆ ਗਏ ਆ ਸਿਸਟਮ ਆ ਗਿਆ ਸਟਾਫ਼ ਆ ਗਿਆ ਪੁਰਾਣੇ ਸਮੇਂ ਦੇ ਵਿੱਚ ਇੱਕ ਤਾਂ ਸਟਾਫ਼ ਦੀ ਬਹੁਤ ਘਾਟ ਸੀਗੀ ਜਿੰਨੇ ਵੀ ਸਾਡੇ ਖੇਤਰ ਦੇ ਵਿੱਚ ਹੈਲਥ ਕੇਅਰ ਦੇ ਨਾਲ ਰਿਲੇਟਡ ਹੋਸਪਿਟਲ ਨੇ ਲੋਕ ਵੀ ਅੱਜ ਕੱਲ੍ਹ ਵਧੀਆ ਜਾਗਰੂਕ ਹੋ ਗਏ ਨੇ ਉਹਨਾਂ ਨੂੰ ਜਾਣਕਾਰੀ ਮਿਲ ਗਈ ਵੀ ਹਸਪਤਾਲ ਦੇ ਵਿੱਚ ਸਾਨੂੰ ਕੀ ਕੀ ਸੁਵਿਧਾ ਮਿਲਦੀ ਹੈ ਤਾਂ ਸਾਰੇ ਜਿਹੜੇ ਦਿਹਾਤ ਦੇ ਵਿੱਚ ਲੋਕ ਰਹਿੰਦੇ ਆ ਸ਼ਹਿਰਾਂ ਦੇ ਵਿੱਚ ਵੀ ਰਹਿੰਦੇ ਆ ਉਹ ਸਭ ਤੋਂ ਪਹਿਲਾਂ ਕੀ ਆ ਹੈਲਥ ਕੇਅਰ ਸਿਸਟਮ ਆ ਜਿਹੜਾ ਵਧੀਆ ਜਿੱਥੇ ਮਿਲਦਾ ਉਥੇ ਪਹੁੰਚਦੇ ਆ ਅੱਜ ਕੱਲ੍ਹ ਦੇਖਣ ਦੇ ਵਿੱਚ ਇਹ ਆਇਆ ਜਿਹੜੀ ਹੁਣ ਪੰਜਾਬ ਸਰਕਾਰ ਹੀ ਦੇਖ ਲਓ ਤੁਸੀਂ ਇਹਨਾਂ ਨੇ ਵੀ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਆ ਬਹੁਤ ਹੀ ਵਧੀਆ ਉਹ ਮੁਹੱਲਾ ਕਲੀਨਿਕ ਨੇ ਜਿਹਦੇ ਵਿੱਚ ਸਟਾਫ਼ ਵੀ ਵਧੀਆ ਦਵਾਈ ਵੀ ਫਰੀ ਆ ਬਹੁਤ ਹੀ ਵਧੀਆ ਸੁਧਾਰ ਹੋਇਆ ਦੂਸਰਾ ਜਿਹੜਾ ਇਹ ਅੱਜਕੱਲ੍ਹ ਦੀਆਂ ਮਸ਼ੀਨਾਂ ਨੇ ਜਿਹੜੀਆਂ ਮੈਡੀਕਲ ਦੇ ਨਾਲ ਰਿਲੇਟਡ ਨੇ ਨਵੀਂ ਟੈਕਨੋਲਜੀ ਦੀਆਂ ਉਹ ਵੀ ਹਸਪਤਾਲਾਂ ਦੇ ਵਿੱਚ ਮੁਹੱਈਆ ਹੋ ਗਈਆਂ ਨੇ ਜਿਹੜੀ ਟਕਨੀਕ ਆ ਗਈ ਦਿਨ ਪਰ ਦਿਨ ਉਹ ਵੱਧਦੀ ਜਾ ਰਹੀ ਹੈ ਜਿੰਨੇ ਵੀ ਟੈਸਟ ਹੁੰਦੇ ਆ ਹਸਪਤਾਲਾਂ ਦੇ ਵਿੱਚ ਹਰੇਕ ਚੀਜ਼ ਉਪਲਬਧ ਆ ਜਿਹੜੇ ਸਟਾਫ਼ ਨੇ ਕਰਨੇ ਆ ਉਹ ਵੀ ਉੱਥੇ ਆ ਕੀ ਕਰਨਾ ਉਹਦੇ ਬਾਰੇ ਉਸ ਸਟਾਫ਼ ਨੂੰ ਪੂਰੀ ਨੌਲੇਜ ਆ ਜੀ ਤਾਂ ਜੀ ਜਿਹੜਾ ਵੀ ਹੁਣ ਅਸੀਂ ਹਸਪਤਾਲਾਂ ਵਿੱਚ ਦੇਖਿਆ ਪਹਿਲਾਂ ਨਾਲੋਂ ਬਹੁਤ ਹੀ ਬੈਟਰ ਆ ਸਾਫ ਸਫਾਈ ਲਾ ਲਓ ਤੁਸੀਂ ਅਕੋਮੋਡੇਸ਼ਨ ਲਾ ਲਓ ਉਹਦਾ ਲੇਆਉਟ ਲਾ ਲਓ ਜਿਹੜੇ ਵਾਰਡ ਬਣੇ ਆ ਅਲੱਗ ਅਲੱਗ ਬਣੇ ਹੋਏ ਬੱਚਿਆਂ ਦੇ ਵਾਰਡ ਫੀਮੇਲ ਵਾਰਡ ਕੈਂਸਰ ਡਿਪਾਰਟਮੈਂਟ ਅਲੱਗ ਅਲੱਗ ਤਰ੍ਹਾਂ ਦੇ ਕੀ ਹੈ ਇਹ ਅਕੋਮੋਡੇਸ਼ਨ ਦੇ ਵਿੱਚ ਕੀ ਹੈ ਇਹ ਜਿਹੜੀ ਬਿਮਾਰੀ ਨੂੰ ਜਿਹੜਾ ਡਾਕਟਰ ਦੇਖਦਾ ਉਹਦਾ ਅਲੱਗ ਰੂਮ ਬਣਿਆ ਹੋਇਆ ਅਲੱਗ ਵਾਰਡ ਬਣੀ ਹੋਈ ਆ ਈ ਐਨ ਟੀ ਈਅਰ ਦੀ ਹੋ ਗਈ ਅਰਥੋ ਵਾਲੇ ਹੋ ਗਏ ਕੈਂਸਰ ਵਾਲੇ ਹੋ ਗਏ ਜਿਹਨਾਂ ਨੂੰ ਕੋਈ ਵੀ ਪ੍ਰੋਬਲਮ ਆ ਗਈ ਸਕਿੰਨ ਆਲੇ ਹੋ ਗਏ ਸਾਰੀਆਂ ਵਾਰਡਾਂ ਕੀ ਆ ਅਲੱਗ ਅਲੱਗ ਉਪਲਬਧ ਨੇ ਬਹੁਤ ਹੀ ਵਧੀਆ ਜਿਹੜਾ ਹਸ ਹਸਪਤਾਲਾਂ ਦੇ ਵਿੱਚ ਸਫਾਈ ਸਫਾਈ ਕਰਮਚਾਰੀ ਅੱਜ ਕੱਲ੍ਹ ਬਹੁਤ ਵਧੀਆ ਕੰਮ ਕਰਦੇ ਆ ਜਾਂ ਤਾਂ ਇਹ ਮੰਨ ਲਓ ਤੁਸੀਂ ਬੇਰੁਜ਼ਗਾਰੀ ਲਾ ਲਓ ਵੀ ਨੌਕਰੀ ਨਹੀਂ ਮਿਲਦੀ ਜਦੋਂ ਉਹ ਜਾਂਦੇ ਆ ਪੋਚਾ ਝਾੜੂ ਸਫਾਈ ਸਾਰਾ ਕੁਛ ਬਹੁਤ ਹੀ ਵਧੀਆ ਹਸਪਤਾਲਾਂ ਦੇ ਵਿੱਚ ਇਹ ਸਾਰਾ ਕੁਛ ਸਾਨੂੰ ਜੀ ਉੱਥੇ ਦੇਖਣ ਨੂੰ ਮਿਲਿਆ ਦੂਜਾ ਅੱਜ ਕੱਲ੍ਹ ਜਿਹੜੀ ਟੈਕਨੋਲਜੀ ਆ ਬਹੁਤ ਵਧੀਆ ਜਿਹੜਾ ਇਲਾਜ ਕਰਨ ਲਈ ਅਸੀਂ ਕਿਤੇ ਬਾਹਰ ਜਾਂਦੇ ਸੀਗੇ ਉਹ ਸਾਰਾ ਸਾਡੇ ਖੇਤਰ ਦੇ ਵਿੱਚ ਹੀ ਕੀ ਆ ਉਹ ਸਾਨੂੰ ਮਿਲ ਰਿਹਾ ਉਹ ਜਿਵੇਂ ਡੈਲਸਿਸ ਕਰਨੇ ਆ ਕਿਸੇ ਦੇ ਕੋਈ ਪੱਥਰੀ ਹੋ ਰਹੀ ਆ ਕੋਈ ਬੱਚਾ ਆਉਣ ਵਾਲਾ ਕਿਸੇ ਫੈਮਲੀ ਦੇ ਉਹ ਸਾਰਾ ਕੁਛ ਹੀ ਕੀ ਆ ਸਾਨੂੰ ਸਾਡੇ ਖੇਤਰ ਦੇ ਵਿੱਚ ਹੀ ਉਪਲਬਧ ਆ ਤਾਂ ਜਿਹੜੀਆਂ ਵੀ ਸਰਕਾਰਾਂ ਨੇ ਹੁਣ ਜਾਂ ਟੈਕਨੋਲਜੀ ਆ ਬਹੁਤ ਵਧੀਆ ਕੰਮ ਕਰਦੀਆਂ ਨੇ ਹਸਪਤਾਲਾਂ ਦੀ ਰੂਪ ਰੇਖਾ ਹੀ ਬਦਲੀ ਪਈ ਹੈ ਬਹੁਤ ਵਧੀਆ ਸੁਧਾਰ ਆ ਹਸਪਤਾਲਾਂ ਦੇ ਵਿੱਚ ਸਾਫ ਸਫਾਈ ਸਟਾਫ ਮੈਡੀਸਨ ਜਿਹੜੀ ਆਉਂਦੀ ਹੈਗੀ ਅਕਮੋਡੇਸ਼ਨ ਸਾਰਾ ਕੁਛ ਹੀ ਬਹੁਤ ਵਧੀਆ ਇਹ ਸਾਰੀਆਂ ਗੱਲਾਂ ਸੀ ਜੀ ਹੁਣ ਹਸ ਪਤਾਲ ਦੇ ਵਿੱਚ ਦੇਖਦੇ ਹਾਂ ਬਹੁਤ ਸੁਧਾਰ ਹੋਇਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ